ਪੰਜਾਬ ਦੇ ਸੱਭਿਆਚਾਰ ਦੀ ਗੱਲ ਕਰੀਏ ਤਾਂ ਪੰਜਾਬ ਦਾ ਸੱਭਿਆਚਾਰ ਬਹੁਤ ਹੀ ਦੂਰ ਦੂਰ ਤੱਕ ਫੈਲਿਆ ਹੋਇਆ ਹੈ ਇੱਥੇ ਹਰੇਕ ਹੀ ਧਰਮ ਦੇ ਲੋਕ ਰਹਿੰਦੇ ਹਨ ਪੰਜਾਬ ਵਿੱਚ ਜਿਸ ਕਰਕੇ ਇੱਥੇ ਤਿਉਹਾਰ ਹਰੇਕ ਹੀ ਧਰਮ ਦੇ ਮਨਾ ਲੋਕ ਮਨਾਉਂਦੇ ਹਨ ਇੱਥੇ ਮੌਸਮ ਮੌਸਮ ਹੋ ਗਿਆ ਤਿਉਹਾਰ ਹੋ ਗਿਆ ਮਹਾਂਪੁਰਖਾਂ ਕਰਕੇ ਇਹਨਾਂ ਕਰਕੇ ਆਪਣਾ ਇਤਿਹਾਸ ਵੀ ਬਹੁਤ ਵੱਡਾ ਹੈ ਜਿਵੇਂ ਲੋਹੜੀ ਹੋ ਗਈ ਦੀਵਾਲੀ ਹੋ ਗਈ ਦੀਵਾਲੀ ਸਿੱਖ ਇਸ ਲਈ ਮਨਾਉਂਦੇ ਹਨ ਕਿ ਉੱਥੇ ਜੋ ਬੰਦੀ ਛੋੜ ਦਿਵਸ ਮਨਾਇਆ ਜਾਂਦਾ ਗੁਰੂ ਹਰਗੋਬਿੰਦ ਸਿੰਘ ਜੀ ਕਰਕੇ ਅਤੇ ਜੋ ਹਿੰਦੂ ਲੋਕ ਨੇ ਉਹਨਾਂ ਦੇ ਸ਼੍ਰੀ ਰਾਮ ਚੰਦਰ ਜੀ ਭਗਵਾਨ ਜੋ ਹੈ ਉਹ ਆਯੋਧਿਆ ਤੋਂ ਚੌਦ੍ਹਾਂ ਸਾਲਾਂ ਬਾਅਦ ਵਾਪਸ ਆਏ ਸਨ ਅਤੇ ਹੋਰ ਇੱਥੇ ਮੇਲੇ ਵੀ ਬਹੁਤ ਲੱਗਦੇ ਹਨ ਜਿਵੇਂ ਗੁੱਗਾ ਨੌਮੀ ਗੁੱਗਾ ਨੌਮੀ ਦਾ ਮੇਲਾ ਹੁੰਦਾ ਗੁੱਗੇ ਪੀਰ ਦੀ ਯਾਦ ਵਿੱਚ ਅਤੇ ਗੋਸਾਈਆਂ ਵਾਲਾ ਮੇਲਾ ਹੁੰਦਾ ਇੱਥੇ ਮੋਹਾਲੀ ਵਿਖੇ ਵੀ ਲੱਗਦਾ ਗੋਸਾਈਆਂ ਵਾਲਾ ਮੇਲਾ ਅਤੇ ਜੋ ਲੋਕ ਇੱਥੇ ਆਪਣੇ ਇਤਿਹਾਸ ਕਰਕੇ ਹੀ ਜੁੜੇ ਹੋਏ ਹਨ ਜਿਸ ਕਰਕੇ ਆਪਣੇ ਪੰਜਾਬੀਆਂ ਵਿੱਚ ਪਿਆਰ ਦੀ ਭਾਵਨਾ ਹਮੇਸ਼ਾ ਹੀ ਬਰਕਰਾਰ ਰਹੇਵੇਗੀ